ਮੇਰੀਆਂ ਪਸੰਦੀਦਾ ਸ਼ੈਲੀਆਂ ਦੇ ਵਿੱਚ ਮੈਂ ਸਿੱਖ ਧਰਮ ਨੂੰ ਬਹੁਤ ਜ਼ਿਆਦਾ ਮੇਰੀ ਆਸਥਾ ਹੈ ਸਿੱਖ ਧਰਮ ਨੂੰ ਮੈਂ ਬਿਲੌਗ ਕਰਦਾ ਮੇਰੀ ਫੈਮਿਲੀ ਸਿੱਖ ਧਰਮ ਨੂੰ ਬਿਲੌਗ ਕਰਦੀ ਹੈ ਇਹਨਾਂ ਵਿੱਚੋਂ ਸਿੱਖ ਧਰਮ ਦੇ ਨਾਲ ਇੱਕ ਰਿਲੇਟਡ ਮੇਰੀ ਮੈਨੂੰ ਮੇਰੀ ਮਾਸੀ ਦੇ ਮੁੰਡੇ ਨੇ ਮੇਰਾ ਦਾਗਿਸਤਾਨ ਕਿਤਾਬ ਪੜ੍ਹਨ ਲਈ ਕਿਹਾ ਅਤੇ ਉਹ ਤਕਰੀਬਨ ਉਹ ਆਪ ਖੁਦ ਤਿੰਨ ਚਾਰ ਵਾਰ ਪੜ੍ਹ ਚੁੱਕਿਆ ਅਤੇ ਮੈਂ ਉਹ ਕਿਤਾਬ ਪੜ੍ਹੀ ਅਤੇ ਉਹਦੇ ਵਿੱਚ ਸਿੱਖਾਂ ਬਾਰੇ ਕਿਵੇਂ ਸਿੱਖਾਂ 'ਤੇ ਤਸ਼ੱਦਦ ਹੋਇਆ ਸਿੱਖ ਕੌਮ ਕਿਵੇਂ ਨਿਮੀ ਆਈ ਹੈ ਇਹ ਪਹਿਲਾਂ ਕਿਵੇਂ ਸੀਗੀ ਅਤੇ ਕਿੱਥੇ ਤੱਕ ਇਹਨਾਂ ਦਾ ਏਰੀਆ ਸੀਗਾ ਮਹਾਰਾਜਾ ਰਣਜੀਤ ਸਿੰਘ ਦਲੀਪ ਸਿੰਘ ਸਾਰਿਆਂ ਮਹਾਰਾਜਿਆਂ ਬਾਰੇ ਯੋਧਿਆਂ ਬਾਰੇ ਅਕਾਲੀ ਫੂਲਾ ਸਿੰਘ ਬਾਰੇ ਲਿਖਿਆ ਗਿਆ ਅਤੇ ਉਹਦੇ ਵਿੱਚ ਕ ਉਹ ਮੈਂ ਤਾਂ ਪੜ੍ਹੀ ਹੈ ਕਿਉਂਕਿ ਮੈਂ ਆਪਣੇ ਜਿਹੜਾ ਅੱਗੇ ਅੱਗੇ ਯੂਥ ਹੈ ਉਹ ਸਿੱਖ ਕੌਮ ਨੂੰ ਭੁੱਲਦਾ ਜਾ ਰਿਹਾ ਸਿੱਖ ਕੌਮ ਦੇ ਰਿਲੇਟਡ ਕੋਈ ਵੀ ਕਿਤਾਬ ਕੋਈ ਚੱਜ ਦੀ ਆ ਨਹੀਂ ਰਹੀ ਹੈਗੀ ਹੈ ਤਕਰੀਬਨ ਮੈਂ ਆਪਣੇ ਬੱਚਿਆਂ ਵਾਸਤੇ ਬੱਚਿਆਂ ਨੂੰ ਦੱਸਣ ਵਾਸਤੇ ਬੱਚਿਆਂ ਦੇ ਅਗਾਂਹ ਬੱਚਿਆਂ ਨੂੰ ਜਦ ਤੱਕ ਉਮਰ ਹੈ ਦੱਸਣ ਵਾਸਤੇ ਮੈਂ ਕਿਤਾਬ ਪੜ੍ਹੀ ਹੈ